ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਬਹੁਤ ਸਾਰੇ ਉਦਯੋਗ ਅਤੇ ਆਰਥਿਕ ਚਾਲਕ ਹਨ ਜਿਵੇਂ ਕਿ ਲੋਕ ਖੇਤੀਬਾੜੀ ਕਰਕੇ ਆਪਣੇ ਆਰਥਿਕ ਕਿਰੂਰਤਾਂ ਨੂੰ ਪੂਰੀਆਂ ਕਰਦੇ ਹਨ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਬਹੁਤ ਸਾਰੇ ਖੇਤੀਬਾੜੀ ਹੁੰਦੀ ਹੈ ਜਿਵੇਂ ਕਿ ਸਬਜ਼ੀਆਂ ਦੀ ਖੇਤੀ ਕਣਕ ਦੀ ਖੇਤੀ ਚੌਲਾਂ ਦੀ ਖੇਤੀ ਅਤੇ ਜਦੋਂ ਇਹ ਫ਼ਸਲ ਤਿਆਰ ਹੋ ਜਾਂਦੀ ਹੈ ਇਸ ਨੂੰ ਮੰਡੀਆਂ ਵਿੱਚ ਭੇਜ ਕੇ ਕਿਸਾਨ ਆਪਣੀ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਸਾਡੇ ਜ਼ਿਲ੍ਹੇ ਵਿੱਚ ਕਈ ਸਾਰੀਆਂ ਫੈਕਟਰੀਆਂ ਵੀ ਹਨ ਜਿਵੇਂ ਕਿ ਸਾਬਣ ਦੀ ਫੈਕਟਰੀ ਲੱਕੜ ਦੀ ਫੈਕਟਰੀ ਅਤੇ ਗੱਤਾ ਫੈਕਟਰੀ ਇਸ ਦੀ ਵਰਤੋਂ ਨਾਲ ਸਾਡੇ ਜ਼ਿਲ੍ਹੇ ਦੇ ਕਾਫ਼ੀ ਸਾਰੇ ਮਜ਼ਦੂਰਾਂ ਅਤੇ ਕਈ ਸਾਰੇ ਗਰੀਬ ਲੋਕਾਂ ਨੂੰ ਆਰਥਿਕ ਕੰਮ ਮਿਲ ਗਿਆ ਹੈ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਜ਼ਰੂਰਤ ਪੂਰੀ ਹੋ ਜਾਂਦੀ ਹੈ ਇਸ ਲਈ ਇਹ ਸਾਡੇ ਜ਼ਿਲ੍ਹੇ ਵਿੱਚ ਬਹੁਤ ਹੀ ਵਧੀਆ ਤਰੱਕੀ ਕੀਤੀ ਗਈ ਹੈ